ਵੈਸੇ ਤਾਂ ਮੈਂ ਬਹੁਤ ਸਾਰੀਆਂ ਪੇਂਟਿੰਗਾਂ ਬਣਾਉਂਦੀ ਹਾਂ ਪਰ ਮੇਰੀ ਨੈਚੁਰਲ ਵਿਊ ਵਾਲੀ ਪੇਂਟਿੰਗ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਸੀ ਅਤੇ ਉਸ ਪੇਂਟਿੰਗ ਨੂੰ ਦੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਉਹ ਪੇਂਟਿੰਗ ਇੱਕ ਕੁਦਰਤ ਸਰੋਤਾਂ ਨਾਲ਼ ਭਰੀ ਹੋਈ ਲੱਗਦੀ ਹੈ ਅਤੇ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਉਹ ਬਿਨ੍ਹਾਂ ਕਲਰ ਤੋਂ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਜਦੋਂ ਉਹ ਬਿਨ੍ਹਾਂ ਕਲਰ ਕੀਤੇ ਆਪਣੇ ਘਰਦਿਆਂ ਨੂੰ ਅਤੇ ਆਪਣੇ ਘਰ ਦਿਆਂ ਨੂੰ ਅਤੇ ਦੋਸਤਾਂ ਨੂੰ ਦਿਖਾਈ ਤਾਂ ਉਹਨਾਂ ਨੂੰ ਬਹੁਤ ਹੀ ਸੋਹਣੀ ਲੱਗੀ ਪਰ ਜਦੋਂ ਮੈਂ ਉਸ ਵਿੱਚ ਕਲਰ ਕੀਤੇ ਕਲਰ ਕਰਨੇ ਤੋਂ ਬਾਅਦ ਜਦੋਂ ਮੈਂ ਆਪਣੇ ਘਰ ਦਿਆਂ ਨੂੰ ਦੋਸਤਾਂ ਨੂੰ ਦਿਖਾਈ ਤਾਂ ਉਹ ਮੇਰੇ ਤੋਂ ਬਹੁਤ ਭਾਵੁਕ ਹੋਏ ਉਹਨਾਂ ਨੂੰ ਮੇਰੀ ਪੇਂਟਿੰਗ ਬਹੁਤ ਹੀ ਜ਼ਿਆਦਾ ਸੁੰਦਰ ਲੱਗੀ ਇਹ ਮੇਰੇ ਹੁਨਰ ਨੂੰ ਦੇਖ ਕੇ ਉਹਨਾਂ ਨੇ ਮੇਰੀ ਬਹੁਤ ਪ੍ਰਸ਼ੰਸਾ ਕੀਤੀ ਮੇਰੇ ਘਰ ਦਿਆਂ ਨੇ ਮੇਰੀ ਇਸ ਪੇਂਟਿੰਗ ਨੂੰ ਸਾਡੀ ਗੈਲਰੀ ਵਿੱਚ ਲਗਵਾ ਦਿੱਤੀ ਅਤੇ ਉਹ ਮੈਨੂੰ ਬਹੁਤ ਸੁੰਦਰ ਲੱਗਦੀ ਹੈ ਅਤੇ ਮੈਂ ਆਉਂਦੇ ਜਾਂਦੇ ਹਰ ਵੇਲੇ ਉਸਨੂੰ ਵੇਖਦੀ ਰਹਿੰਦੀ ਹਾਂ ਮੈਨੂੰ ਉਹ ਦੇਖ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਮੈਨੂੰ ਉਸ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ